ਹੈਲੋ ਸਰ ਸਰ ਤੁਸੀਂ ਔਲਾ ਕੰਪਨੀ ਤੋਂ ਬੋਲਦੇ ਪਏ ਜੇ ਸਰ ਅਸੀਂ ਇੱਕ ਕੈਬ ਬੁੱਕ ਕਰਵਾਈ ਸੀ ਇਹ ਅੰਬਾਲੇ ਜਾਣਾ ਅਤੇ ਬੁਕ ਕੈਬ ਦਾ ਨੰਬਰ ਹੈਗਾ ਹੈ ਪੀ ਬੀ ਪੈਂਤੀ ਪੈਂਤੀ ਤੁਸੀਂ ਉਨ੍ਹਾਂ ਦੇ ਡਰਾਈਵਰ ਬੋਲਦੇ ਪਏ ਜੇ ਸਰ ਅਸੀਂ ਇਹ ਪੁੱਛਣਾ ਚਾਹੁੰਦੇ ਸੀ ਕਿ ਤੁਸੀਂ ਕੈਬ ਦੇ ਵਿੱਚ ਕਿੰਨੇ ਜਣੇ ਬੈਠ ਸਕਦੇ ਆ ਅਸੀਂ ਫੁੱਲ ਫੈਮਿਲੀ ਜਾ ਰਹੇ ਹਾਂ ਸਾਡੇ ਬੱਚੇ ਆ ਨਾਲ ਨਾਲ ਇੱਕ ਫਰੈਂਡ ਵੀ ਹੋਏਗਾ ਕਿ ਉਹਦੇ ਵਿੱਚ ਅਸੀਂ ਆਰਾਮ ਨਾਲ ਬੈਠ ਸਕਦੇ ਹਾਂ ਕਿਉਂਕਿ ਸਫਰ ਬਹੁਤ ਦੂਰ ਦਾ ਅਤੇ ਤੁਸੀਂ ਸਾਨੂੰ ਕਿਸ ਟਾਈਮ 'ਤੇ ਪਹੁੰਚਾ ਸਕਦੇ ਜੇ ਉਹ ਵੀ ਤੁਸੀਂ ਦੱਸ ਦਿਉ ਬਾਕੀ ਇਹ ਕਿ ਅਸੀਂ ਜਿਹੜੇ ਪੈਸਿਆਂ ਦਾ ਭੁਗਤਾਨ ਆ ਉਹ ਤੁਹਾਨੂੰ ਅਸੀਂ ਉੱਥੇ ਜਾ ਕੇ ਹੀ ਕਰਾਂਗੇ ਅਤੇ ਤੁਸੀਂ ਜਿਹੜੇ ਪੈਸੇ ਆ ਉਹ ਤੁਸੀਂ ਕਿਸ ਤਰ੍ਹਾਂ ਲੈਂਦੇ ਜੇ ਪੈਸੇ ਦਾ ਜਾਂ ਤਾਂ ਤੁਸੀਂ ਦੱਸ ਦਿਉ ਕਿ ਕੈਸ਼ ਲੈਂਦੇ ਜੇ ਕਿ ਜਾਂ ਤੁਸੀਂ ਪ੍ਰੋਸੀਜਰ ਤੁਹਾਡਾ ਚੇਂਜ ਹੋ ਗਿਆ ਕਿ ਤੁਸੀਂ ਕਿਸ ਹਿਸਾਬ ਨਾਲ ਪੈਸੇ ਲੈਂਦੇ ਜੇ ਅਤੇ ਜਾਂ ਔਨਲਾਈਨ ਲੈਣੀ ਆ ਉਹ ਤੁਸੀਂ ਦੱਸ ਦਿਉ ਅਤੇ ਸਾਨੂੰ ਦੱਸ ਦਿਉ ਉਸ ਹਿਸਾਬ ਨਾਲ ਤੁਹਾਡੇ ਨਾਲ ਅਸੀਂ ਕੋਂਟੈਕਟ ਕਰ ਲਵਾਂਗੇ